ਨਗਰ ਪਾਲਿਕਾ ਦਾ ਕਰਤਵ ਹੁੰਦਾ ਹੈ ਕਿ ਉਹ ਸਾਡੇ ਇਲਾਕੇ ਦੇ ਡਰੇਨੇਜ਼ ਸਿਸਟਮ ਸਫਾਈ ਕਰਮਚਾਰੀਆਂ ਅਤੇ ਸੜਕਾਂ ਦੀ ਸਾਫ਼ ਸਫਾਈ ਦਾ ਧਿਆਨ ਰੱਖਣ ਅਤੇ ਨਾਲ ਹੀ ਪਿੰਡਾਂ ਦੇ ਵਿੱਚ ਪੰਚਾਇਤ ਦਾ ਅਹੁਦਾ ਹੁੰਦਾ ਹੈ ਕਿ ਉਹ ਪਿੰਡ ਦੇ ਵਿੱਚ ਕਿਸੇ ਵੀ ਝਗੜੇ ਦਾ ਨਿਪਟਾਰਾ ਕਰਨ ਲਈ ਉਹ ਪੰਚਾਇਤ ਪਿੰਡ ਵਿੱਚ ਕਾਰਜ ਕਰਦੀ ਹੈ